ਸ਼ੇਅਰ ਮਾਰਕੀਟ ਸ਼ੇਅਰ ਮਾਰਕੀਟ ਦੇ ਵਿੱਚ ਲੋਕ ਜਿਹੜੇ ਹੈਗੇ ਹੈਗੇ ਸ਼ੇਅਰ ਖਰੀਦਦੇ ਆ ਵੇਚਦੇ ਆ ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਹੈਗੇ ਇਹਦੇ ਵਿੱਚ ਸ਼ੇਅਰਸ ਕਰਦੇ ਹੈਗੇ ਆ ਖਰੀਦਦੇ ਹੈਗੇ ਆ ਠੀਕ ਹੈ ਵੇਚਦੇ ਹੈਗਾ ਆ ਇਸ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਗਾ ਵੀ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ ਹੈਗਾ ਗਾ ਵੀ ਇਹਦੇ ਨਾਲ ਜਿਹੜਾ ਹੈਗਾ ਗਾ ਵੀ ਫਾਇਦਾ ਵੀ ਬਹੁਤ ਹੁੰਦਾ ਇਸ ਆਪਾਂ ਆਏਂ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਸਿਰਫ ਫਾਇਦਾ ਹੀ ਫਾਇਦਾ ਹੁੰਦਾ ਜਿਸ ਵੀ ਚੀਜ਼ ਦਾ ਕੋਈ ਫਾਇਦਾ ਹੁੰਦਾ ਉਸਦਾ ਨਾਲ ਨਕਸਾਨ ਵੀ ਹੁੰਦਾ ਇਸ ਵਿੱਚ ਨੁਕਸਾਨ ਵੀ ਹੁੰਦਾ ਸੋ ਦੋਨੇ ਚੀਜ਼ਾਂ ਹੁੰਦੀਆਂ ਇਸ ਦੇ ਵਿੱਚ ਉਤਰਾਅ ਵੀ ਆਉਂਦਾ ਅਤੇ ਚੜ੍ਹਾਅ ਵੀ ਆਉਂਦਾ ਇੰਡੀਆ ਦੇ ਵਿੱਚ ਇਸ ਟੈਮ ਦੇ ਵਿੱਚ ਜਿਹੜੀ ਹੈਗੀ ਆ ਨੈਫਟੀ ਕੋਪਨੀ ਹੈਗੀ ਹੈ ਜਿਹੜੀ ਉਹ ਟੋਪ ਦੇ ਉੱਪਰ ਚੱਲ ਰਹੀ ਹੈ ਨੈਫਟੀ ਬੈਂਕ ਆ ਜਿਹੜਾ ਉਹ ਬਹੁਤ ਉਸਦੇ ਬਹੁਤ ਵਧੀਆ ਸ਼ੇਅਰ ਜਿਹੜੇ ਹੈਗੇ ਹੈਗੇ ਬਣ ਰਹੇ ਹੈਗੇ ਆ ਮੇਰਾ ਵੀ ਮਨ ਕਰਦਾ ਹੈਗਾ ਵੀ ਜਿਹੜੇ ਮੈਂ ਨਿਫਟੀ ਕੋਪਨੀ ਦੇ ਨਾਲ ਜਿਹੜੇ ਹੈਗੇ ਹੈਗੇ ਸ਼ੇਅਰ ਕਰਾਂ ਬਟ ਜਿਵੇਂ ਆਪਾਂ ਪਹਿਲੇ ਹੀ ਕਿਹਾ ਸੀਗਾ ਵੀ ਕੋਈ ਵੀ ਚੀਜ਼ ਹੈਗੀ ਆ ਜਿਹੜੀ ਵੀ ਉਹਨਾਂ ਦੇ ਡਰੋਬੈਕਸ ਜਾਂ ਵੀ ਨੁਕਸਾਨ ਹੁੰਦੇ ਹੈਗੇ ਆ ਤਾਂ ਇਸ ਦੇ ਵਿੱਚ ਜਿਵੇਂ ਆਪਣੇ ਕੋਲ ਜਿਹੜੇ ਡੋਨ ਜਿਹੜੀ ਹੈਗੀ ਹੈਗੀ ਕੋਪਨੀ ਜਿਹੜੀ ਉਹ ਚੱਲ ਰਹੀ ਹੈਗੀ ਹੈਗੀ ਉਹ ਹੈਗੀ ਹੈਗੀ ਬਰਾਈਟ ਕੌਮ ਕੋਪਨੀ ਜਿਹੜੀ ਹੈਗੀ ਹੈਗੀ ਉਹ ਡੋਨ ਚੱਲ ਰਹੀ ਹੈਗੀ ਹੈਗੀ ਸੋ ਸ਼ੇਅਰ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਗਾ ਡੋਨਫੋਲ ਵੀ ਹੁੰਦਾ ਹੈਗਾ ਅਤੇ ਵੀ ਰਾਈਜ਼ ਅਪ ਵੀ ਹੁੰਦਾ ਹੈਗਾ ਸੋ ਆਪਾਂ ਹਰੇਕ ਚੀਜ਼ ਨੂੰ ਪੋਜ਼ਟਿਵ ਲੈਣਾ ਨੈਗਟਿਵ ਵੱਲ ਨਹੀਂ ਜਾਣਾ ਆਪਾਂ ਜਿਵੇਂ ਨਿਫਟੀ ਬੈਂਕ ਜਿਹੜੀ ਹੈਗੀ ਨਿਫਟੀ ਕੋਪਨੀ ਹੈਗੀ ਆ ਉਹ ਬਹੁਤ ਵਧੀਆ ਕੰਮ ਜਿਹੜਾ ਹੈਗਾ ਆਪਣਾ ਕਰ ਰਹੀ ਹੈੈਗੀ ਹੈਗੀ ਸੋ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਗਾ ਉਹਨਾਂ ਦੇ ਸ਼ੇਅਰ ਮਾਰਕੀਟਸ ਬਾਰੇ ਜਾਣ ਕੇ ਨਿਫਟੀ ਬਾਰੇ ਜਾਣ ਕੇ ਸੋ ਮੈਂ ਵੀ ਚਾਹੁੰਦੀ ਹੈਗੀ ਹਾਂ ਵੀ ਜਿਹੜਾ ਵੀ ਨਿਫਟੀ ਅਤੇ ਜਿਹੜੇ ਹੈਗੇ ਹੈਗੇ ਆਪਣੇ ਸ਼ੇਅਰ ਕਰਾਂ